ਪੱਚੀ ਸੱਤ ਦੋ ਹਜ਼ਾਰ ਛੇ ਛੇ ਅੱਠ ਦੋ ਹਜ਼ਾਰ ਸੱਤ ਸਤਾਈ ਪੰਜ ਦੋ ਹਜ਼ਾਰ ਇੱਕ ਉੱਨਤੀ ਤਿੰਨ ਦੋ ਹਜ਼ਾਰ ਦੋ ਪੰਦਰ੍ਹਾਂ ਚਾਰ ਦੋ ਹਜ਼ਾਰ ਸਤਾਰ੍ਹਾਂ